ਹਾਂਜੀ ਮੈਂ ਕੈਬ ਕੀਤੀ ਸੀ ਅਤੇ ਉਹ ਤੁਹਾਡਾ ਡਰਾਈਵਰ ਨਹੀਂ ਪਹੁੰਚਿਆ ਮੈਨੂੰ ਨਹੀਂ ਪਤਾ ਤੁਸੀਂ ਉਹਨੂੰ ਗਲਤ ਐਡਰੇਸ ਦਿੱਤਾ ਹੈ ਜਾਂ ਉਸ ਨੇ ਗਲਤ ਐਡਰੇਸ ਲਿਆ ਹੈ ਇਹ ਤੁਸੀਂ ਵੇਖਣਾ ਸੀ ਮੇਰੀ ਕੈਬ ਮੇਰੇ ਸਮੇਂ 'ਤੇ ਨਹੀਂ ਪਹੁੰਚੀ ਮੇਰੇ ਦਿੱਤੇ ਹੋਏ ਸਮੇਂ 'ਤੇ ਨਹੀਂ ਪਹੁੰਚੀ ਅਤੇ ਮੈਂ ਲੇਟ ਹੋ ਗਿਆ ਇਸ ਕਰਕੇ ਨਹੀਂ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਾਂਗਾ ਕਿਉਂਕਿ ਤੁਸੀਂ ਮੇਰੀ ਕੈਬ ਨੂੰ ਮੇਰੇ ਸਮੇਂ 'ਤੇ ਨਹੀਂ ਪਹੁੰਚਾਇਆ ਮੈਂ ਤੁਹਾਡੀ ਇਸ ਕੈਬ ਦੀ ਜਗ੍ਹਾ ਹੁਣ ਹੋਰ ਕੈਬ ਕਰ ਲਈ ਏ ਕਿਰਪਾ ਕਰਕੇ ਤੁਸੀਂ ਜਿਹੜੀ ਮੈਂ ਕੈਬ ਕੀਤੀ ਸੀ ਉਸ ਨੂੰ ਕੈਂਸਲ ਕਰ ਦਿਓ ਕਿਉਂਕਿ ਤੁਹਾਡਾ ਡਰਾਈਵਰ ਬਿਲੁਕਲ ਲੇਟ ਪਹੁੰਚਿਆ ਹੈ ਅਤੇ ਉਸ ਤੋਂ ਪਹਿਲਾਂ ਮੇਰੀ ਪਹਿਲਾਂ ਵਾਲੀ ਕੈਬ ਜਿਹੜੀ ਕਿ ਮੈਂ ਦੁਬਾਰਾ ਕੀਤੀ ਸੀ ਉਹ ਆ ਚੁੱਕੀ ਹੈ ਸੋ ਕਿਰਪਾ ਕਰਕੇ ਜਿਹੜੀ ਕੈਬ ਦੇ ਬਾਰੇ ਹੁਣ ਤੁਸੀਂ ਗੱਲ ਕਰ ਰਹੇ ਹੋ ਉਸ ਨੂੰ ਕੈਂਸਲ ਕਰ ਦਿੱਤਾ ਜਾਵੇ ਮੈਂ ਦੂਸਰੀ ਕੰਪਨੀ ਦੀ ਕੈਬ ਆਰਡਰ ਕਰ ਦਿੱਤੀ ਹੈ ਅਤੇ ਉਹ ਮੇਰੇ ਦਰਵਾਜ਼ੇ 'ਤੇ ਖੜ੍ਹੀ ਹੈ ਸੋ ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਇਸ ਕੈਬ ਨੂੰ ਕੈਂਸਲ ਕਰ ਦਿਓ